ਮੇਰੇ ਕੋਲ ਏਅਰਟੈਲ ਦੀ ਸਿੰਮ ਹੈ ਮੈਂ ਉਸ ਦਾ ਰੀਚਾਰਜ ਦੋ ਸੌ ਨੜਿਨਵੇਂ ਵਾਲ਼ਾ ਕਰਵਾਉਂਦਾ ਹਾਂ ਉਸ ਵਿੱਚ ਮੈਨੂੰ ਡੇਢ ਜੀ ਬੀ ਮਿਲ ਜਾਂਦੀ ਹੈ ਅਤੇ ਹੋਰ ਅਨਲਿਮਟਿਡ ਕੋਲਿੰਗ ਵੀ ਮਿਲ ਜਾਂਦੀ ਹੈ ਅਤੇ ਸੌ ਮੈਸਿਜ ਮਿਲ ਜਾਂਦੇ ਹਨ ਅਤੇ ਮੈਨੂੰ ਨੈੱਟ ਉਹ ਨੈੱਟ ਬਹੁਤ ਫਾਸਟ ਚੱਲਦਾ ਹੈ ਅਤੇ ਸਾਡੇ ਘਰਦਿਆਂ ਨੇ ਜੀਓ ਦੀ ਸਿੰਮ ਲਈ ਹੋਈ ਹੈ ਪਰ ਸਾਡੇ ਪਿੰਡ ਵਿੱਚ ਜੀਓ ਦਾ ਟਾਵਰ ਹੈ ਅਤੇ ਮੈਂ ਇਸ ਲਈ ਏਅਰਟੈਲ ਦੀ ਸਿੰਮ ਲਈ ਹੈ ਮੈਨੂੰ ਬਾਹਰ ਕਿਤੇ ਦੂਰ ਜਾਣਾ ਪੈਂਦਾ ਹੈ ਇਸ ਕਰ ਕੇ ਮੈਂ ਏਅਰਟੈਲ ਦੀ ਸਿੰਮ ਲਈ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਮੈਨੂੰ ਜੇਕਰ ਕਿਸੇ ਨੂੰ ਜੇਕਰ ਕਿਸੇ ਨੇ ਦੂਰ ਕਿਤੇ ਜਾਣਾ ਹੋਵੇ ਅਤੇ ਏਅਰਟੈਲ ਦੀ ਸਿੰਮ ਲਿਆ ਕਰੋ